ਮਿਊਜਿਕ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਮੈਨੂੰ ਸਭ ਤੋਂ ਵੱਧ ਖੁਸ਼ ਕਰਦੀ ਹੈ ਮੇਰੇ ਫੇਵਰਟ ਜਿਹੜੇ ਮੇਰੇ ਪਸੰਸੀਦਾ ਸਿੰਗਰ ਨੇ ਸਿੱਧੂ ਮੂਸੇਆਲਾ ਜਿਵੇਂ ਕਿ ਉਹਦੇ ਗਾਣੇ ਹੋ ਗਏ ਅਨਬੀਟੇਬਲ ਜਾਂ ਫਿਰ ਆਊਟਲੋਅ ਜਿਹੜੇ ਕਿ ਮੇਰੇ ਬਹੁਤ ਮਨਪਸੰਦ ਨੇ ਅਤੇ ਸਤਿੰਦਰ ਸਰਤਾਜ ਦੇ ਗਾਣੇ ਇੱਕ ਇੱਕੋ ਮਿੱਕੇ ਗੁਰਦਾਸ ਮਾਨ ਦੇ ਗਾਣੇ ਜਿਵੇਂ ਛੱਲਾ ਅਤੇ ਜੁਗਨੀ ਇਹ ਸਭ ਗਾਣੇ ਮੇਰੇ ਮਨਪਸੰਦ ਨੇ ਅਤੇ ਇਹਨਾਂ ਨੂੰ ਮੈਂ ਬਹੁਤ ਵਾਰੀ ਸੁਣਦਾਂ ਅਤੇ ਗਾਣੇ ਹੀ ਅਸਲ ਦੇ ਵਿੱਚ ਏ ਮੇਰੀ ਸੱਚੀ ਖੁਸ਼ੀ ਹਨ ਅਤੇ ਮੈਨੂੰ ਇਹਨਾਂ ਚੀਜ਼ਾਂ ਤੋਂ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ